ਮੈਨੂੰ ਹਰਭਜਨ ਮਾਨ ਦਾ ਗੀਤ ਜੱਗ ਜਿਉਂਦਿਆਂ ਦੇ ਮੇਲੇ ਬਹੁਤ ਪਸੰਦ ਹੈ ਜੋ ਕਿ ਮੈਂ ਬਹੁਤ ਹੀ ਗੁਣਗੁਣਾਉਂਦੀ ਹਾਂ ਉਸ ਦੀ ਗਾਇਕੀ ਇੰਨੀ ਸਾਫ ਸੁਥਰੀ ਹੈ ਕਿ ਅਸੀਂ ਆਪਣੇ ਪਰਿਵਾਰ ਵਿੱਚ ਵੱਡਿਆਂ ਨਾਲ ਬੈਠ ਕੇ ਸੁਣ ਸਕਦੇ ਹਾਂ ਅਤੇ ਹਰ ਇੱਕ ਗੀਤ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਜਿਵੇਂ ਪੰਜਾਬ ਦੇ ਸੱਭਿਆਚਾਰ 'ਤੇ ਕੋਈ ਵਿਦੇਸ਼ ਦੀ ਗੱਲ ਹੋ ਰਹੀ ਹੈ ਵਿਦੇਸ਼ ਵੱਸਦੇ ਪੰਜਾਬੀਆਂ 'ਤੇ ਅਤੇ ਪਰਿਵਾਰ ਦੇ ਮਸਲਿਆਂ 'ਤੇ ਅਤੇ ਹੋਰ ਜੋ ਵੀ ਪ੍ਰੋਬਲਮਸ ਨੇਗੀਆਂ ਪੰਜਾਬ ਦੀਆਂ ਕਹਿ ਲਓ ਬਾਹਰ ਦੀਆਂ ਕਹਿ ਲਓ ਬੱਚਿਆਂ ਦੀਆਂ ਕਹਿ ਲਓ ਉਸ 'ਤੇ ਹਰ ਇੱਕ ਚੀਜ਼ ਦਾ ਇੱਕ ਸਪੈਸ਼ਲ ਅਰਥ ਹੁੰਦਾ ਅਤੇ ਉਹਨਾਂ ਦੇ ਜਿਹੜੇ ਗੀਤ ਨੇ ਉਹ ਸਾਨੂੰ ਅੱਗੇ ਵੀ ਮੋਟੀਵੇਟ ਕਰਦੇ ਨੇ ਅਤੇ ਜਿਹਦੇ ਵਿੱਚ ਬਹੁਤ ਹੀ ਆਨੰਦ ਆਉਂਦਾ ਅਤੇ ਸੁਣਨਾ ਵੀ ਬਹੁਤ ਪਸੰਦ ਹੈ ਮੈਨੂੰ